ਸਾਨੂੰ ਆਪਣੇ ਜੀਵਨ ਦੇ ਵਿੱਚ ਕਸਰਤ ਦੇ ਨਾਲ ਨਾਲ ਯੋਗਾ ਨੂੰ ਵੀ ਅਪਣਾਉਣਾ ਚਾਹੀਦਾ ਹੈ ਯੋਗਾ ਤੁਹਾਡੇ ਸਰੀਰ ਵਿੱਚ ਲਚਕ ਤੁਹਾਡੀ ਤੰਦਰੁਸਤੀ ਨੂੰ ਬਹੁਤ ਚੰਗਾ ਬਣਾਵੇਗਾ ਤੁਹਾਡਾ ਪਾਚਨ ਸ਼ਕਤੀ ਚੰਗੀ ਹੋਵੇਗੀ ਤੁਹਾਡਾ ਧਿਆਨ ਇਕਾਗਰ ਹੋਣ ਲੱਗ ਜਾਵੇਗਾ ਅਤੇ ਬਹੁਤ ਸਾਰੀਆਂ ਚਿੰਤਾਵਾਂ ਬਹੁਤ ਸਾਰੀਆਂ ਤੁਹਾਡੀਆਂ ਬਿਮਾਰੀਆਂ ਯੋਗਾ ਸ਼ੁਰੂ ਕਰਨ ਨਾਲ ਦੂਰ ਹੋ ਜਾਣਗੀਆਂ ਕਿਉਂਕਿ ਯੋਗਾ ਇੱਕ ਪਾਸੇ ਮਨ ਨੂੰ ਇਕਾਗਰ ਕਰਦਾ ਹੈ ਅਤੇ ਸਾਡੇ ਸਰੀਰ ਨੂੰ ਲਚਕਤਾ ਵੀ ਪ੍ਰਦਾਨ ਕਰਦਾ ਹੈ ਸਾਡੀਆਂ ਬਹੁਤ ਸਾਰੀਆਂ ਦਿਮਾਗੀ ਪਰੇਸ਼ਾਨੀਆਂ ਜਦੋਂ ਅਸੀਂ ਧਿਆਨ ਕਰਦੇ ਹਾਂ ਉਦੋਂ ਦੂਰ ਹੁੰਦੀਆਂ ਹਨ ਅਤੇ ਸਾਡੇ ਮਨ ਵਿੱਚ ਕੋਈ ਸ਼ਾਂਤੀ ਆਉਂਦੀ ਹੈ ਵੱਖ ਵੱਖ ਕਿਰਿਆਵਾਂ ਨਾਲ ਜੋ ਯੋਗਾ ਦੇ ਅੰਦਰ ਕਰਦੇ ਹਾਂ ਸਾਡਾ ਸਰੀਰ ਬੜਾ ਲਚਕਦਾਰ ਬਣਦਾ ਹੈ ਸਾਡਾ ਪੇਟ ਦੀ ਜੋ ਮਾਸ ਹੈ ਉਹ ਵੀ ਘਟਦਾ ਹੈ ਮੋਟਾਪਾ ਦੂਰ ਹੁੰਦਾ ਹੈ ਅਤੇ ਅਸੀਂ ਬਹੁਤ ਸਾਰੇ ਜਿਹੜੇ ਜੀਵਨ ਦੇ ਵਿੱਚ ਕੰਮ ਨੇ ਬੜੇ ਸੁਖਾਲੇ ਤਰੀਕੇ ਨਾਲ ਕਰ ਸਕਦੇ ਹਾਂ ਬਾਕੀ ਵਿਅਕਤੀ ਜੋ ਅੱਜ ਕੱਲ੍ਹ ਦੇ ਜੀਵਨ ਦੇ ਵਿੱਚ ਕਸਰਤ ਤੋਂ ਦੂਰ ਹਨ ਉਹਨਾਂ ਨੂੰ ਯੋਗਾ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਯੋਗਾ ਉਹਨਾਂ ਦੇ ਰੋਜ਼ਾਨਾ ਦੇ ਕੰਮਕਾਰ ਵਿੱਚ ਵੀ ਉਹਨਾਂ ਦੀ ਮਦਦ ਕਰੇਗਾ ਉਹਨਾਂ ਦਾ ਧਿਆਨ ਵੀ ਟਿਕੇਗਾ ਅਤੇ ਇਸ ਦੇ ਨਾਲ ਨਾਲ ਉਹਨਾਂ ਦਾ ਸਰੀਰਕ ਸਮਰੱਥਾ ਵੀ ਵਧੇਗੀ ਉਹਨਾਂ ਦੀ ਤਾਕਤ ਵਧੇਗੀ ਸਾਰਿਆਂ ਨੂੰ ਯੋਗਾ ਕਰਨਾ ਚਾਹੀਦਾ ਹੈ